ਮੇਰੇ ਅਨੁਸਾਰ ਭੰਗੜਾ ਆਭਿਖ ਭਵਿੱਖ ਵਿਚ ਬਹੁਤ ਜਿਆਦਾ ਪ੍ਰਸਿੱਧ ਹੈ ਕਿਉਂਕਿ ਪੰਜਾਬ ਦਾ ਇਹ ਕਲਚਰ ਕਿਸੇ ਵੀ ਸਕੂਲ ਕਾਲਜ ਵਿੱਚ ਚਲਜੋ ਤੁਹਾਨੂੰ ਸਭ ਤੋਂ ਜਿਆਦਾ ਭੰਗੜੇ ਦੀ ਆਈਟਮ ਜਿਆਦਾ ਦੇਖਣ ਨੂੰ ਮਿਲੇਗੀ ਜਿਵੇਂ ਕਿ ਆਪਣੇ ਜਿਆਦਾ ਲੋਕ ਫੋਰਨ ਗਏ ਹੋਏ ਉਥੋਂ ਦੇ ਲੋਕ ਬਹੁਤ ਜਿਆਦਾ ਅੰਗਰੇਜ਼ ਅੰਗਰੇਜ਼ਾਂ ਨੂੰ ਵੀ ਬਹੁਤ ਜਿਆਦਾ ਪਸੰਦ ਆ ਰਿਹਾ ਕਿਸੇ ਫੰਕਸ਼ਨ ਤੇ ਚਲ ਜਓ ਕਿਸੇ ਵਿਆਹ ਤੇ ਚਲ ਜਓ ਉੱਥੇ ਤੁਹਾਨੂੰ ਕੀਤਾ ਭੰਗੜਾ ਜਿਆਦਾ ਆਈਟਮ ਇਹ ਮਿਲੇਗੀ ਔਰ ਲੋਕੀ ਜਿਆਦਾ ਬਹੁਤ ਖੂਬ ਬਹੁਤ ਜਿਆਦਾ ਇਹਨੂੰ ਪਸੰਦ ਕੀਤਾ ਜਾ ਰਿਹਾ ਮੇਰੇ ਨਾਲ ਮੇਰੇ ਮੁਤਾਬਿਕ ਇਹ ਬਹੁਤ ਜਿਆਦਾ ਪ੍ਰਸਿੱਧ ਹੋਵੇਗਾ